ਸਾਡੇ ਖੇਤਰ ਵਿੱਚ ਸਰਕਾਰੀ ਹਸਪਤਾਲ ਵੀ ਹੈ ਅਤੇ ਪ੍ਰਾਈਵੇਟ ਹਸਪਤਾਲ ਵੀ ਹੈ ਅਤੇ ਪ੍ਰਸ਼ਾਸ਼ਨ ਨੇ ਛੋਟੇ ਛੋਟੇ ਜਾਂਚ ਕੇਂਦਰ ਵੀ ਖੋਲ੍ਹੇ ਹੋਏ ਹਨ ਇੱਥੇ ਹਰ ਤਰ੍ਹਾਂ ਦੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਇਲਾਜ ਬਹੁਤ ਮਹਿੰਗਾ ਵੀ ਨਹੀਂ ਹੈ ਅਤੇ ਇਲਾਜ ਸਸਤਾ ਹੋ ਜਾਂਦਾ ਹੈ ਸਰੀਰਕ ਟੈਸਟ ਕਰਨ ਲਈ ਲੈਬਾਂ ਦਾ ਇੰਤਜਾਮ ਸਰਕਾਰ ਵੱਲੋਂ ਕੀਤਾ ਹੋਇਆ ਹੈ ਇਹਨਾਂ ਸਿਹਤ ਕੇਂਦਰਾਂ ਤੱਕ ਪਹੁੰਚਣ ਲਈ ਆਵਾਜਾਈ ਦੇ ਸਾਧਨ ਵੀ ਪ੍ਰਸ਼ਾਸ਼ਨ ਵੱਲੋਂ ਉਪਲਬਧ ਕੀਤੇ ਹੋਏ ਹਨ ਤਾਂ ਜੋ ਲੋਕ ਅਸਾਨੀ ਨਾਲ਼ ਇੱਥੇ ਆ ਸਕਣ